ਹਾਂਜੀ ਮੇਰਾ ਨਾਮ ਰਾਕੇਸ਼ ਹੈ ਮੈਂ ਸੁਜਾਨਪੁਰ ਦੀ ਰਹਿਣ ਹਾਂ ਡਿਸਟਿਕ ਪਠਾਨਕੋਟ ਤੋਂ ਬਿਲੋਂਗ ਕਰਦੀ ਹਾਂ ਮੇਰੇ ਕੋਲ ਬਹੁਤ ਸਾਰੀਆਂ ਮੇਰੀਆਂ ਮਨਪਸੰਦ ਕਿਤਾਬਾਂ ਹਨ ਜਿਸਦੇ ਵਿੱਚੋਂ ਮੇਰੀਆਂ ਦੋ ਹਿਸਟਰੀ ਦੀਆਂ ਕਿਤਾਬਾਂ ਬਹੁਤ ਹੀ ਮਨਪਸੰਦ ਹਨ ਇੱਕ ਹੈ ਹਰੱਪਾ ਸਿਵਿਲਾਈਜੇਸ਼ਨ ਔਰ ਸੈਕਿੰਡ ਹੈ ਮੇਡਿਵੀਅਲ ਪੀਰੀਅਡ ਹਰੱਪਾ ਸਿਵਿਲਾਈਜੇਸ਼ਨ ਦੀ ਜੋ ਕਿਤਾਬ ਹੈ ਇਹ ਮੇਰੀ ਮਨਪਸੰਦ ਇਸ ਕਰਕੇ ਹੈ ਕਿਉਂਕਿ ਹਰੱਪਾ ਜੋ ਹੈ ਇਹ ਸਾਡੇ ਕਹਿ ਸਕਦੇ ਹਾਂ ਵੀ ਸਾਡੇ ਦੇਸ਼ ਦੀ ਪਹਿਲੀ ਸੱਭਿਅਤਾ ਹੈ ਜਿਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਇਸ ਕਿਤਾਬ ਦੇ ਵਿੱਚ ਕਿ ਸਾਡੀ ਪਹਿਲੀ ਸੱਭਿਅਤਾ ਹੈ ਸਾਡੇ ਭਾਰਤ ਦੀ ਪਹਿਲੀ ਸੱਭਿਅਤਾ ਹੈ ਜੋ ਕਿ ਨਦੀ ਦੇ ਕੰਡੇ ਸਿੰਧੂ ਘਾਟੀ ਦੇ ਕੰਡੇ ਸ਼ੁਰੂ ਹੋਈ ਅਤੇ ਇਸ ਦੇ ਨਾਲ ਸਾਡਾ ਬਹੁਤ ਹੀ ਮਾਨ ਵੱਧਦਾ ਹੈ ਕਿ ਸਾਰੇ ਹੀ ਦੇਸ਼ਾਂ ਦੇ ਵਿੱਚ ਜਿਹੜੀ ਪਹਿਲੀ ਸੱਭਿਅਤਾ ਮੰਨੀ ਗਈ ਹੈ ਉਹ ਹਰੱਪਾ ਸਿਵਿਲਾਈਜੇਸ਼ਨ ਨੂੰ ਹੀ ਮੰਨਿਆ ਗਿਆ ਹੈ ਬਹੁਤ ਪੁਰਾਣੀ ਸੱਭਿਅਤਾ ਹੈ ਜਿਸ ਦੇ ਵਿੱਚ ਸਾਨੂੰ ਪਤਾ ਚੱਲਦਾ ਹੈ ਕਿ ਉਹ ਸੱਭਿਅਤਾ ਜੋ ਸੀ ਪੇਂਡੂ ਸੱਭਿਅਤਾ ਨਾ ਹੋ ਕੇ ਪੇਂਡੂ ਸੱਭਿਅਤਾ ਨਾ ਹੋ ਕੇ ਇੱਕ ਸ਼ਹਿਰੀ ਸੱਭਿਅਤਾ ਸੀ ਜਿਸ ਦੇ ਵਿੱਚ ਅੱਜ ਵੀ ਅਸੀਂ ਜੇ ਦੇਖੀਏ ਤਾਂ ਉਹ ਚੰਡੀ ਵੜਗੀ ਚੰਡੀਗੜ੍ਹ ਵਰਗੇ ਸ਼ਹਿਰ ਨੂੰ ਵੀ ਕੀ ਦਿੰਦੀ ਹੈ ਮਾਤ ਦਿੰਦੀ ਹੈ ਉਹ ਸੱਭਿਅਤਾ ਉਸਦੀਆਂ ਨਾਲੀਆਂ ਉਸ ਦਾ ਇਨਫਰਾਸਟਰਕਚਰ ਜੋ ਬਣਿਆ ਹੋਇਆ ਸੀ ਬਿਲਡਿੰਗ ਰੋਸ਼ਨੀ ਦਾ ਪ੍ਰਬੰਧ ਉਹ ਸਭ ਜੋ ਕੁਝ ਲਿਖਿਆ ਹੋਇਆ ਹੈ ਉਹ ਪੜ੍ਹਨ ਦਾ ਇੱਕ ਮਜ਼ਾ ਜਿਹਾ ਆ ਜਾਂਦਾ ਹੈ ਮਾਣ ਪ੍ਰਾਪਤ ਹੁੰਦਾ ਹੈ ਮਾਨ ਮਹਿਸੂਸ ਹੁੰਦਾ ਹੈ ਕਿ ਸਾਡੀ ਭਾਰਤ ਦੀ ਸੱਭਿਅਤਾ ਇੰਨੀ ਉੱਚੀ ਸੱਭਿਅਤਾ ਤੇ ਪੁਰਾਣੀ ਸੱਭਿਅਤਾ ਹੈ ਦੂਜੀ ਕਿਤਾਬ ਹੈ ਮੇਡੀਵੀਅਲ ਪੀਰੀਅਡ ਹੈ ਜਿਸਦੇ ਵਿੱਚ ਅਸੀਂ ਅਕਬਰ ਅਤੇ ਹੋਰ ਕਈ ਰਾਜਿਆਂ ਦੇ ਬਾਰੇ ਪੜ੍ਹਦੇ ਹਾਂ ਪਰ ਉਨ੍ਹਾਂ ਦੇ ਵਿੱਚੋਂ ਸਭ ਤੋਂ ਮੇਰਾ ਮਨਪਸੰਦ ਜਿਹੜੇ ਰਹੇ ਨੇ ਕਿੰਗ ਉਹ ਅਕਬਰ ਸੀਗੇ ਜਿਨ੍ਹਾਂ ਨੇ ਦੀਨ ਏ ਇਲਾਹੀ ਸ਼ੁਰੂ ਕੀਤਾ ਅਤੇ ਸਾਰਿਆਂ ਨੂੰ ਇੱਕ ਜਿਹਾ ਮੰਨਿਆ ਸਾਰੇ ਧਰਮਾਂ ਨੂੰ ਇੱਕ ਜਿਹਾ ਮੰਨਿਆ ਧੰਨਵਾਦ ਇਹੋ ਜਿਹੀਆਂ ਕਿਤਾਬਾਂ ਸਾਰਿਆਂ ਨੂੰ ਹੀ ਪੜ੍ਹਨੀਆਂ ਚਾਹੀਦੀਆਂ ਹਨ